ਤੈਰਾਕੀ ਸਿਹਤ ਲਈ ਬਹੁਤ ਲਾਭਦਾਇਕ ਹੈ ਅਤੇ ਉਸ ਵਿੱਚ ਸਾਨੂੰ ਲੱਤਾਂ ਬਾਹਾਂ ਆਦਿ ਸਭ ਕੁਛ ਹਿਲਾਉਣਾ ਪੈਂਦਾ ਹੈ ਕੱਲ੍ਹ ਇਸ ਕਰਕੇ ਮੈਂ ਆ ਕੱਲ੍ਹ ਆਪਣੇ ਪਿੰਡ ਦੇ ਸੂਏ ਵਿੱਚ ਨਹਾਉਣ ਗਿਆ ਪਰ ਮੈਂ ਉਸ ਦੇ ਵਿੱਚ ਸਾਹ ਤੈਰਾਕੀ ਕਰਨ ਦੀ ਨਿਯੰਤਰਨ ਕੀਤਾ ਪਰ ਉਹ ਮੇਰੇ ਕੋਲੋਂ ਨਹੀਂ ਹੋ ਪਾਇਆ ਪਰ ਉਸ ਨੂੰ ਸਾਹ ਤੈਰਾਕੀ ਕਰਨ ਲਈ ਸਾਨੂੰ ਚਾਰ ਜਾਂ ਪੰਜ ਮਿੰਟ ਤੋਂ ਵੱਧ ਨਹੀਂ ਕਰ ਸਕਦੇ